ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੁਸੀਂ ਆਪਣਾ ਬਜਟ ਦੱਸ ਸਕਦੇ ਹੋ ਕਿੰਨਾ ਕੁ ਬਜਟ ਹੈ ਤੁਹਾਡਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਦੇਖੋ ਬਾਈਸਾਈਕਲ ਦੋਨੋਂ ਕੈਟੇਗਰੀ 'ਚ ਮਿਲ ਜਾਣਗੀਆਂ ਵੈਸੇ ਬੱਚੇ ਅੱਜ ਕੱਲ੍ਹ ਗੇਅਰਾਂ ਵਾਲੀ ਪਸੰਦ ਕਰਦੇ ਹੈ ਪਰ ਜੇ ਬੱਚਾ ਛੋਟਾ ਹੈ ਤਾਂ ਫਿਰ ਉਹਨੂੰ ਵਿਦਆਊਟ ਗੇਅਰ ਬਿਨਾਂ ਗੇਅਰ ਤੋਂ ਚੱਲ ਜਾਏਗੀ ਹੈ ਨਾ ਜੀ ਅਤੇ ਬੱਚਾ ਉਮਰ ਦੱਸ ਉਮਰ ਦੱਸ ਸਕਦੇ ਹੋ ਕਿੰਨੀ ਕੁ ਹੈ ਬੱਚੇ ਦੀ ਉਮਰ ਅੱਛਾ ਅੱਛਾ ਫਿਰ ਤੁਸੀਂ ਗੇਅਰ ਵਾਲਾ ਵੀ ਲੈ ਸਕਦੇ ਹੋ ਦੇਖੋ ਜੀ ਪੰਜ ਹਜ਼ਾਰ ਤੋਂ ਸਟਾਰਟਿੰਗ ਹੈ ਠੀਕ ਹੈ ਜੀ ਅਤੇ ਜਿਹੜਾ ਇਹ ਹੈ ਕਿ ਬੱਚੇ ਦੇ ਹਿਸਾਬ ਨਾਲ ਜਿਵੇਂ ਹਾਈਟ ਵੀ ਵੱਧ ਜਾਂਦੀ ਹੈ ਤਾਂ ਮੈਨੂੰ ਲੱਗਦਾ ਤੁਹਾਨੂੰ ਪੰਜ ਹਜ਼ਾਰ ਤੋਂ ਦਸ ਹਜ਼ਾਰ ਦੇ ਬਜਟ ਦੇ ਵਿੱਚ ਹੀ ਲੈਣੀ ਚਾਹੀਦੀ ਆ ਵੈਸੇ ਤਾਂ ਬਜਟ ਉਸ ਤੋਂ ਵੀ ਉੱਪਰ ਹੋਰ ਕਾਫ਼ੀ ਬਾਈਸਾਈਕਲ ਹੈਗੇ ਨੇ ਪਏ ਵਧੀਆ ਪਰ ਮੈਨੂੰ ਲੱਗਦਾ ਕਿ ਤੁਹਾਡੇ ਹੈ ਨਾ ਕਿਉਂਕਿ ਬੱਚੇ ਵੱਡੇ ਹੁੰਦੇ ਨੇ ਹਾਈਟ ਨਿਕਲ ਆਉਂਦੀ ਆ ਫਿਰ ਚੇਂਜ ਕਰਨਾ ਪੈ ਜਾਂਦਾ ਤਾਂ ਪੰਜ ਤੋਂ ਦਸ ਹਜ਼ਾਰ ਦੇ ਵਿੱਚ ਵਿੱਚ ਜਿਹੜਾ ਹੈਗਾ ਤੁਹਾਨੂੰ ਮਿਲ ਜੇਗਾ ਹਾਂਜੀ ਹਾਂਜੀ ਹਾਂਜੀ ਦੇਖੋ ਸਾਡੇ ਕੋਲ ਐਵੀਲੇਬਲ ਹੈਗੇ ਨੇ ਜੀ ਤੁਸੀਂ ਆ ਸਕਦੇ ਹੋ ਬਸ ਸਵ ਸਵੇਰੇ ਦਸ ਵਜੇ ਤੋਂ ਬਾਅਦ ਕਿਸੇ ਵੀ ਟਾਈਮ ਸ਼ਾਮ ਨੂੰ ਸੱਤ ਵਜੇ ਤੱਕ ਸ਼ੋਪ ਓ ਖੁੱਲ੍ਹੀ ਹੈ ਜੀ ਤੁਸੀਂ ਕਿਸੇ ਵੀ ਟਾਈਮ ਵਿਜ਼ਿਟ ਕਰ ਸਕਦੇ ਹੋ ਆ ਸਕਦੇ ਹੋ ਹਾਂਜੀ ਹਾਂਜੀ ਐਡਰੈੱਸ ਲੈ ਲਓ ਆਪਾਂ ਉਹਦਾ ਨਾ ਤੁਸੀਂ ਅਗਰ ਤੁਹਾਨੂੰ ਕੋਈ ਦਿੱਕਤ ਆਈ ਤੁਸੀਂ ਇਸ ਨੰਬਰ 'ਤੇ ਕੋਲ ਕਰ ਲਿਓ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਨੂੰ ਡਰੈਕਸ਼ਨ ਵਗੈਰਾ ਜਾਂ ਹੈ ਨਾ ਲੋਕੇਸ਼ਨ ਵਗੈਰਾ ਭੇਜ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਸ਼ੁਕਰੀਆ